ਮੈਂ ਅੱਜ ਤੋਂ ਦੋ ਸਾਲ ਪਹਿਲਾਂ ਇੱਕ ਮਿ ਟੁੱਟਦਾ ਤਾਰਾ ਦੇਖਿਆ ਸੀਗਾ ਜਿਸਦੇ ਜੋ ਕਿ ਮੇਰੇ ਘਰ ਦੇ ਲਵੇ ਹੀ ਟੁੱਟ ਕੇ ਲੰਘ ਰਿਹਾ ਸੀ ਅਤੇ ਮੈਂ ਉਸ ਤੋਂ ਇਹ ਖੁਆਇਸ਼ ਮੰਗੀ ਸੀ ਕਿ ਮੈਂ ਇੱਕ ਬੜਾ ਕਾਮਯਾਬ ਇਨਸਾਨ ਬਣਾ ਅਤੇ ਉਹ ਸ ਤਾਰਾ ਬੜਾ ਸੋਹਣਾ ਲੱਗ ਰਿਹਾ ਸੀ ਜਦੋਂ ਉਹ ਟੁੱਟ ਕੇ ਨਿਕਲ ਰਿਹਾ ਸੀ ਅਤੇ ਮੈਂ ਉਸਦੀ ਫੋਟੋ ਖਿੱਚਣ ਦੀ ਵੀ ਕੋਸ਼ਿਸ਼ ਕਰੀ ਬਟ ਉਹ ਬਹੁਤ ਤੇਜ਼ੀ ਦੇ ਨਾਲ ਨਿਕਲ ਗਿਆ ਬਟ ਉਸਦੀ ਉਸਦੇ ਕਾਰਨ ਮੈਂ ਉਸਤੋਂ ਜਿਹੜੀ ਮੈਂ ਖੁਆਇਸ਼ ਮੰਗੀ ਸੀ ਉਹ ਹੌਲੀ ਹੌਲੀ ਮੇਰੀ ਪੂਰੀ ਹੋ ਵੀ ਰਹੀ ਹੈ ਅਤੇ ਮੈਂ ਇੱਕ ਮਿਟੇਔਰ ਸ਼ਾਵਰ ਤਾਂ ਦੇਖ ਨਹੀਂ ਪਾਇਆ ਕਿਉਂਕਿ ਜਿੱਥੇ ਮੈਂ ਰਹਿ ਰਿਹਾ ਉੱਥੇ ਕੋਈ ਸੰਭਾਵਨਾ ਨਹੀਂ ਹੈ ਬਟ ਜਦੋਂ ਮੈਂ ਇੱਕ ਟੁੱਟਦਾ ਤਾਰਾ ਦੇਖਿਆ ਉਸ ਤੋਂ ਮੈਂ ਆਪਣੇ ਵਿਸ਼ ਮੰਗਣ ਤੋਂ ਕੋਈ ਭਾਵ ਦੇਰੀ ਨਹੀਂ ਛੱਡੀ ਤੇ ਮੈਂ ਉਸਤੋਂ ਕੋਈ ਆਪਣੀ ਵਿਸ਼ ਵੀ ਮੰਗ ਲਈ ਸੀ ਅਤੇ ਜਿਸਦੇ ਕਾਰਨ ਮੇਰੀ ਹੌਲੀ ਹੌਲੀ ਸਾਰੀ ਇੱਛਾਵਾਂ ਵੀ ਪੂਰੀ ਹੋ ਰਹੀਆਂ ਪਰ ਮੇਰਾ ਇੱਕ ਸੁਪਨਾ ਹੈ ਮੈਂ ਇੱਕ ਮਿਟੇਔਰ ਸ਼ਾਵਰ ਵੀ ਦੇਖ ਕੇ ਆ ਸਕਾਂ ਅਤੇ ਆਪਣੀ ਹਰ ਖੁਆਇਸ਼ ਉਸ ਤੋਂ ਮੈਂ ਅਤੇ ਮੈਂ ਆਪਣੀ ਹਰ ਖੁਆਇਸ਼ ਪੂਰੀ ਕਰ ਪਾਵਾਂ ਅਤੇ ਮੈਂ ਜ਼ਰੂਰ ਕੋਸ਼ਿਸ਼ ਕਰਾਂਗਾ ਕਿ ਮੈਂ ਇੱਕ ਮਿਟੇਔਰ ਸ਼ਾਵਰ ਪੂਰਾ ਦੇਖ ਕੇ ਆ ਸਕਾਂ ਅਤੇ ਇਹ ਜੋ ਮਿਟੇਔਰ ਸ਼ਾਵਰ ਹੈ ਤੁਹਾਨੂੰ ਪਹਾੜਾਂ ਇਲਾਕੇ ਦੇ ਵਿੱਚ ਮਿਲ ਜਾਂਦੇ ਹਨ ਪਰ ਮੈਂ ਇੱਕ ਪਲੇ ਮੈਦਾਨੀ ਇਲਾਕੇ ਦੇ ਵਿੱਚ ਰਹਿ ਰਿਹਾ ਹਾਂ ਜਿਸਕੇ ਕਾਰਨ ਜਿਸਦੇ ਕਾਰਨ ਸਾਨੂੰ ਇੰਨੇ ਨਹੀਂ ਦਿਖਦੇ ਬਹੁਤ ਘੱਟ ਹੀ ਦੇਖਣ ਨੂੰ ਮਿਲਦੇ ਹਨ ਮੈਂ ਕੋਸ਼ਿਸ਼ ਜ਼ਰੂਰ ਕਰਾਂਗਾ ਕਿ ਮੈਂ ਦੁਬਾਰਾ ਕੋਈ ਸ਼ੂਟਿੰਗ ਸਟਾਰ ਦੇਖ ਸਕਾਂ ਜਾਂ ਮਿਟੇਔਰ ਸ਼ਾਵਰ ਦੇਖ ਸਕਾਂ ਅਤੇ ਹੌਲੀ ਹੌਲੀ ਮੈਂ ਆਪਣੀ ਇੱਛਾਵਾਂ ਵੀ ਪੂਰੀ ਕਰ ਪਾਵਾਂ ਅਤੇ ਮੈਂ ਆਪਣੇ ਘਰਦਿਆਂ ਦਾ ਨਾਮ ਵੀ ਰੋਸ਼ਨ ਕਰਾਂ ਅਤੇ ਮੈਂ ਉਹਨਾਂ ਦੀ ਫੋਟੋ ਵੀ ਖਿੱਚਣ ਦਾ ਬੜਾ ਇਛੁੱਕ ਹਾਂ ਅਤੇ ਮੈਨੂੰ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਇੰਟਰਸਟ ਹੈ ਅਤੇ ਮੈਂ ਰੋਜ਼ ਆਪਣੇ ਘਰ ਦੀ ਛੱਤ ਉੱਤੇ ਟੈਲੀਸਕੋਪ ਲਗਾ ਕੇ ਉਹਨਾਂ ਚੀ ਤਾਰੇ ਅਤੇ ਪਲੈਨਟ ਦੇਖਣ ਦੀ ਕੋਸ਼ਿਸ਼ ਕਰਦਾ ਹਾਂ ਅਤੇ ਉਸਦੇ ਵਿੱਚ ਵੀ ਮੈਨੂੰ ਮਿਟੇਔਰ ਤਾਰੇ ਟੁੱਟਦੇ ਵੀ ਦਿਖ ਜਾਂਦੇ ਹਨ ਜਿਸਦੇ ਕਾਰਣ ਮੈਂ ਆਪਣੀ ਵਿਸ਼ ਮੰਗ ਪਾਉਂਦਾ ਹਾਂ ਅਤੇ ਹੌਲੀ ਹੌਲੀ ਮੈਂ ਆਪਣੇ ਹਰ ਚੀਜ਼ ਦੇ ਬਾਰੇ ਜਾਣਕਾਰੀ ਵਧਾ ਕੇ ਆਪਣੀ ਆਪਣੀ ਚੀਜ਼ਾਂ ਬਾਰੇ ਆਪਣੀ ਨੌਲੇਜ ਬਾ ਆਪਣੀ ਨੌਲੇਜ ਵਧਾ ਰਿਹਾ ਹਾਂ ਅਤੇ ਜਿਸਦੇ ਨਾਲ ਨਾਲ ਮੈਂ ਆਪਣੀ ਸਕਿੱਲ ਵੀ ਡਿਵੈਲਪ ਕਰ ਪਾ ਰਿਹਾ ਅਤੇ ਹੌਲੀ ਹੌਲੀ ਮੈਂ ਸਭ ਕੁਛ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਜੋ ਕਿ ਸਾਡੀ ਧਰਤੀ ਦੇ ਵਿੱਚ ਹੈ ਅਤੇ ਅਤੇ ਮੈਂ ਲੇਹ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੇ ਮਿਟੇਔਰ ਸ਼ਾਵਰ ਆ ਅਤੇ ਟੁੱਟਦੇ ਤਾਰੇ ਨੇ ਬਹੁਤ ਜ਼ਿਆਦਾ ਪਾਏ ਜਾਂਦੇ ਹਨ ਤਾਂ ਮੈਂ ਕੋਸ਼ਿਸ਼ ਕਰੂੰਗਾ ਉੱਥੇ ਜਾ ਕੇ ਮੈਂ ਹੋਰ ਟੁੱਟਦੇ ਤਾਰੇ ਦੇਖ ਪਾਵਾਂ ਅਤੇ ਮਿਟੇਔਰ ਸ਼ਾਵਰ ਦੇਖ ਪਾਵਾਂ